ਹੈਲੋ ਸਰ ਤੁ ਸਾਹਿਲ ਹੋਟਲ ਤੋਂ ਬੋਲ ਰਹੇ ਹੋ ਸਰ ਮੈਨੂੰ ਪੰਜ ਤੋਂ ਸੱਤ ਬੰਦਿਆਂ ਵਾਸਤੇ ਖਾਣਾ ਚਾਹੀਦਾ ਸੀਗਾ ਹਾਂਜੀ ਸਰ ਮੈਨੂੰ ਖਾਣੇ ਵਿੱਚ ਸਫੇਦ ਚਨੇ ਸ਼ਾਹੀ ਪਨੀਰ ਚਾਵਲ ਮੱਖਣੀ ਦਾਲ ਅਤੇ ਨਾਨ ਚਾਹੀਦੇ ਠੀਕ ਹੈ ਸਰ ਸਰ ਇੱਕ ਘੰਟੇ ਦੇ ਅੰਦਰ ਅੰਦਰ ਮੇਰੇ ਘਰ ਭੇਜ ਦਿਓ ਪੇਮੈਂਟ ਤੁਸੀਂ ਔਨਲਾਈਨ ਲੈਣਾ ਚਾਹੋਗੇ ਜਾਂ ਕੈਸ਼ ਠੀਕ ਹੈ ਸਰ ਆਪਣਾ ਜੇ ਤੁਸੀਂ ਕੈਸ਼ ਲੈਣਾ ਚਾਹੁੰਦੇ ਹੋ ਤਾਂ ਬਿੱਲ ਦੇ ਦਿਓ ਨਹੀਂ ਤਾਂ ਫਿਰ ਗੂਗਲ ਪੇਅ ਵਾਲਾ ਆਪਣਾ ਨੰਬਰ ਸੈਂਡ ਕਰ ਦਿਉ ਮੈਂ ਆਪਣਾ ਨੰਬਰ ਤੁਹਾਨੂੰ ਸੈਂਡ ਕਰ ਰਹੀ ਹਾਂ ਓਕੇ ਸਰ